ਮੈਨੂੰ ਲੱਗਦਾ ਹੈ ਕੀ ਪੰਜਾਬੀ ਨੂੰ ਮੀਡੀਆ ਵਿੱਚ ਉਚਿਤ ਢੰਗ ਨਾਲ ਨਹੀਂ ਦਰਸਾਇਆ ਜਾਂਦਾ ਕਿਉਂਕਿ ਮੀਡੀਆ ਪੰਜਾਬੀ ਵਿੱਚ ਅੱਜ ਕੱਲ ਕੁਝ ਹੀ ਚੈਨਲ ਰਹਿ ਗਏ ਹਨ ਬਾਕੀ ਚੈਨਲ ਜਿਆਦਾਤਰ ਤਾਂ ਹਿੰਦੀ 'ਚ ਇੰਗਲਿਸ਼ ਵਿੱਚ ਹੀ ਹੁੰਦੇ ਹਨ ਸਿੱਖਿਆ ਦੇ ਤੌਰ 'ਤੇ ਵੀ ਜਦ ਕੀ ਆਪਾਂ ਵੇਖੀਏ ਤਾਂ ਬੱਚਿਆਂ ਨੂੰ ਸਕੂਲਾਂ ਵਿੱਚ ਪੰਜਾਬੀ ਬਹੁਤ ਘੱਟ ਸਿਖਾਈ ਜਾਂਦੀ ਐ ਪੰਜਾਬੀ 'ਤੇ ਬਹੁਤ ਘੱਟ ਜ਼ੋਰ ਦਿੱਤਾ ਜਾਂਦਾ ਹੈ ਜਦ ਕਿ ਉਹਨਾਂ ਨੂੰ ਹਿੰਦੀ ਜਾਂ ਇੰਗਲਿਸ਼ ਵਿੱਚ ਹੀ ਜਿਆਦਾ ਜ਼ੋਰ ਦਿੱਤਾ ਜਾਂਦਾ ਉਹਨਾਂ ਨੂੰ ਜਿਆਦਾ ਚੀਜ਼ਾਂ ਹਿੰਦੀ ਜਾਂ ਇੰਗਲਿਸ਼ ਵਿੱਚ ਹੀ ਦਿਖਾਈਆਂ ਜਾਂਦੀਆਂ ਹਨ ਉਹਨਾਂ ਨੂੰ ਹਿੰਦੀ ਜਾਂ ਇੰਗਲਿਸ਼ ਬੋਲਣ 'ਤੇ ਜਿਆਦਾ ਜ਼ੋਰ ਦਿੱਤਾ ਜਾਂਦਾ ਹੈ ਜਦ ਕੀ ਉਹਨਾਂ ਦੇ ਅੱਜ ਕੱਲ ਸਾਰੇ ਸਬਜੈਕਟ ਵਗੈਰਾ ਉਹਨਾਂ ਦੇ ਇੰਗਲਿਸ਼ 'ਚ ਹੀ ਹੁੰਦੇ ਹਨ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਉਹ ਸਕੂਲੇ ਬੱਚਿਆਂ ਨਾਲ ਆਪਸ ਵਿੱਚ ਇੰਗਲਿਸ਼ ਵਿੱਚ ਜਾਂ ਹਿੰਦੀ ਵਿੱਚ ਹੀ ਗੱਲਬਾਤ ਕਰਨ ਅਗਰ ਉਹਨਾਂ ਨੇ ਮੈਡਮ ਤੋਂ ਕੋਈ ਸਵਾਲ ਕਰਨਾ ਹੈ ਤਾਂ ਉਹ ਵੀ ਇੰਗਲਿਸ਼ ਵਿੱਚ ਹੀ ਉਹਨਾਂ ਤੋਂ ਪੁੱਛਣ ਬੱਚਿਆਂ ਨੂੰ ਸਿੱਖਿਆ ਦੇ ਤੌਰ 'ਤੇ ਬੱਚਿਆਂ ਨੂੰ ਬਹੁਤ ਲੇਟ ਹੀ ਪੰਜਾਬੀ ਸਿਖਾਈ ਜਾਂਦੀ ਹੈ ਉਹਨਾਂ ਨੂੰ ਬਹੁਤ ਲੇਟ ਪੰਜਾਬੀ ਲੱਗਦੀ ਹੈ ਜਿਸ ਕਰਕੇ ਉਹ ਅਪ ਪੰਜਾਬ ਵਿੱਚ ਰਹਿੰਦਿਆਂ ਵੀ ਉਹਨਾਂ ਦੀ ਪੰਜਾਬੀ ਬਹੁਤ ਕਮਜ਼ੋਰ ਹੋ ਜਾਂਦੀ ਹੈਗੀ ਐ ਜਿਸ ਕਰਕੇ ਬੱਚੇ ਪੰਜਾਬੀ ਬੋਲਨੀ ਜਾਂ ਲਿਖਣੀ ਬੋਲੇ ਜਾਂਦੇ ਹਨ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਸਿੱਖਿਆ ਅਤੇ ਮੀਡੀਆ ਵਿੱਚ ਪੰਜਾਬੀ ਨੂੰ ਉਚਿਤ ਰੂਪ ਨਾਲ ਨਹੀਂ ਦਰਸਾਇਆ ਜਾਂਦਾ ਇਸ ਉੱਤੇ ਕੰਮ ਕਰਕੇ ਇਸ ਨੂੰ ਹੋਰ ਵਧੀਆ ਢੰਗ ਨਾਲ ਦਰਸਾਇਆ ਜਾ ਸਕਦਾ ਹੈ